ਮੈਂ ਵਿਜੇ ਗੁਰਦਾਸਪੁਰ ਜਿਲੇ ਦਾ ਵਾਸੀ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੇ ਸਮਾਜ ਵਿੱਚ ਜਾਂ ਅੱਜ ਦੇ ਸਮੇਂ ਮੁਤਾਬਿਕ ਸਾਡੇ ਗਲੋਬਲ ਵਿੱਚ ਪੂਰੇ ਵਰਲਡ ਵਿੱਚ ਪੂਰੀ ਦੁਨੀਆਂ ਵਿੱਚ ਕਈ ਅਜਿਹੀਆ ਚੀਜ਼ਾਂ ਹਨ ਜਿਨਾਂ ਨੇ ਸਾਡੇ ਬ੍ਰਹਮੰਡ ਨੂੰ ਘੇਰਿਆ ਹੋਇਆ ਹੈ ਇਸ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਸਾਡੇ ਸਮਾਜ ਵਿੱਚ ਇੱਕ ਅਜਿਹੀ ਗਲੋਬਲ ਦੀ ਗੱਲ ਹੈ ਕਿ ਜਿਸ ਤਰ੍ਹਾਂ ਸਮੇਂ ਦੇ ਮੁਤਾਬਿਕ ਕੋਈ ਉੱਪਰ ਦੀ ਰਿਸਰਚ ਖੋਜ ਕਰ ਰਿਹਾ ਹੈ ਕਿ ਉੱਪਰ ਕੀ ਕੀ ਚੀਜ਼ਾਂ ਹਨ ਜਾਂ ਸਾਡੇ ਸਮਾਜ ਦੇ ਵਿੱਚ ਇਹ ਵੀ ਇੱਕ ਸਰਚ ਚੱਲ ਰਹੀ ਹੈ ਕੀ ਸਾਡੀ ਧਰਤੀ ਹੇਠ ਕਿੰਨਾ ਕੁ ਪਾਣੀ ਜਾਂ ਕੀ ਕੀ ਪਦਾਰਥ ਲੁਕੇ ਹਨ ਜਾਂ ਕਿੱਥੇ ਕਿੱਥੇ ਖਣਿਜ ਤੇਲ ਆਦੀ ਕੋਲਾ ਆਦੀ ਹੈ ਇਸ ਤਰ੍ਹਾਂ ਨਾਲ ਇਹ ਗੱਲ ਬੜੀ ਹੀ ਵਧੀਆ ਹੈ ਕਿ ਜੇਕਰ ਖਬਰ ਵਿੱਚ ਇਹ ਸੁਣਦੇ ਹਾਂ ਕਿ ਅੱਜ ਸਾਡੇ ਹਿੰਦੁਸਤਾਨ ਜਾਂ ਪੂਰੇ ਦੁਨੀਆਂ ਦੇ ਲੋਕੀ ਬੜੀ ਹੀ ਇਹ ਏ ਖੋਜ ਬੜੀ ਵਧੀਆ ਖੋਜ ਕਰਕੇ ਉੱਪਰ ਆਕਾਸ਼ ਵਿੱਚ ਆਸਮਾਨ ਵਿੱਚ ਪੁੱਜ ਚੁੱਕੇ ਹਨ ਜਿਸ ਤਰ੍ਹਾਂ ਹਾਲ ਹੀ ਵਿੱਚ ਪਿੱਛੇ ਜੇ ਇੱਕ ਰਾਕਟ ਦਾਗਿਆ ਗਿਆ ਜਾਂ ਉਹ ਸੁਨੀਤਾ ਵਿਲੀਅਮ ਔਰ ਆਕਾਸ਼ ਵਿੱਚ ਘੁੰਮ ਰਹੀ ਹੈ ਤੇ ਉਹ ਕਈ ਅਜਿਹੀਆਂ ਚੀਜ਼ਾਂ ਦੀ ਖੋਜ ਕਰਕੇ ਆਵੇਗੀ ਜੋ ਕਿ ਸਾਡੇ ਪੂਰੀ ਦੁਨੀਆਂ ਲਈ ਇੱਕ ਵਧੀਆ ਕਾਰਗੁਜ਼ਾਰੀ ਦਾ ਕੰਮ ਕਰੇਗੀ ਧੰਨਵਾਦ